ਡਾਟਾ ਪਲੈਨ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਡਾਟਾ ਪਲੈਨ ਨਾਲ ਅਸੀਂ ਬੜਾ ਕੁਛ ਕਰ ਸਕਦੇ ਹਾਂ ਕੁਛ ਐਂਟਰਟੇਨਮੈਂਟ ਲਈ ਬੜਾ ਕੁਝ ਦੇਖ ਸਕਦੇ ਹਾਂ ਓ ਟੀ ਟੀ ਪਲੈਟਫੋਰਮਸ ਦੇਖ ਸਕਦੇ ਹਾਂ ਕੁਛ ਵੀਡੀਓਜ਼ ਦੇਖ ਸਕਦੇ ਹਾਂ ਬੜਾ ਕੁਝ ਦੇਖ ਸਕਦੇ ਹਾਂ ਅਤੇ ਸਾਡੇ ਖੇਤਰ ਵਿੱਚ ਸਭ ਤੋਂ ਮਸ਼ਹੂਰ ਪ੍ਰਸਿੱਧ ਡਾਟਾ ਪਲੈਨ ਹੈਗਾ ਛੇ ਸੌ ਜਾਂ ਸੱਤ ਸੌ ਵਾਲਾ ਸੱਤ ਸੌ ਵਾਲਾ ਸਿਕਸ ਨਾਈਨਟੀ ਨਾਈਨ ਦਾ ਉਹ ਸਾਨੂੰ ਵਧੀਆ ਸਾਰੇ ਖੇਤਰ ਸਾਨੂੰ ਉਹੀ ਮਸ਼ਹੂਰ ਆ ਅਤੇ ਸਾਰੇ ਉਹੀ ਸੇਮ ਪਲੈਨ ਖਲਾਂਦੇ ਹੈ ਉਹਦੇ ਵਿੱਚ ਸਾਨੂੰ ਬੜਾ ਕੁਛ ਮਿਲਦਾ ਹੈ ਸਾਨੂੰ ਉਹਦੇ ਵਿੱਚ ਏ ਸਾਨੂੰ ਉਹਦੇ ਵਿੱਚ ਬੜਾ ਕੁਛ ਮਿਲਦਾ ਹੈ ਜਿਵੇਂ ਕਿ ਐਂਟਰਟੇਨਮੈਂਟ ਪਲੈਨ ਵੀਡੀਓ ਦੇਖਣੀਆਂ ਬੜਾ ਕੁਛ ਦੇਖਣਾ ਉਹੀ ਅਤੇ ਸਾਡੇ ਪਰਿਵਾਰ ਨੇ ਵੀ ਉਹੀ ਪਲੈਨ ਚੁਣਿਆ ਵਾ ਸੱਤ ਸੌ ਵਾਲਾ ਉਹ 'ਚ ਕਿਉਂਕਿ ਬੜਾ ਕੁਛ ਮਿਲਦਾ ਉਹ 'ਚ ਨੈਟ ਅਨਲਿਮਿਟੇਡ ਮਿਲਦਾ ਵਾ ਪੂਰੇ ਦੇਰ ਦਾ ਮਿਲਦਾ ਵਾ ਠੀਕ ਆ ਉਹ ਪੂਰੇ ਮਹੀਨੇ ਦਾ ਹੁੰਦਾ ਵਾ ਉਹ ਤੋਂ ਬਾਅਦ ਅਸੀਂ ਉਹਨੂੰ ਫੇਰ ਓਨੇ ਦਾ ਹੀ ਕਰਾ ਸਕਦੇ ਹਾਂ ਅਤੇ ਉਹਦੇ 'ਚ ਸਾਨੂੰ ਬੜਾ ਵਧੀਆ ਪਲੈਨ ਮਿਲਦੇ ਆ ਅਸੀਂ ਬੜਾ ਕੁਛ ਦੇਖਦੇ ਹਾਂ ਟੀ ਵੀ 'ਤੇ ਲਾ ਕੇ ਉਹਨੂੰ ਬੜੇ ਵਧੀਆ ਤਰੀਕੇ ਨਾਲ ਦੇਖਦੇ ਹਾਂ ਥੈਂਕ